ਸਤਿ ਸ਼੍ਰੀ ਅਕਾਲ ਮੈਂ ਅੰਸ਼ ਮਹਾਜਨ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਮੈਂ ਬਚਪਨ ਤੋਂ ਹੀ ਚਿੱਤਰਕਾਰੀ ਵਿੱਚ ਬਹੁਤ ਰੁਚੀ ਰੱਖਦਾ ਹਾਂ ਅਤੇ ਮੈਨੂੰ ਚਿੱਤਰਕਾਰੀ ਦਾ ਬਹੁਤ ਸ਼ੌਕ ਹੈ ਪਰ ਕੁਛ ਜਗ੍ਹਾ 'ਤੇ ਮੈਂ ਵੀ ਚਿੱਤਰਕਾਰੀ ਵਿੱਚ ਗਲਤੀਆਂ ਕਰਦਾ ਆ ਰਿਹਾ ਹਾਂ ਅਤੇ ਅੱਜ ਮੈਂ ਤੁਹਾਡੇ ਸਾਹਮਣੇ ਉਹ ਆਪਣੀ ਗਲਤੀਆਂ ਦੱਸਣ ਜਾ ਰਿਹਾ ਹਾਂ ਜਦ ਵੀ ਕਦੇ ਮੈਂ ਚਿੱਤਰਕਾਰੀ ਵਿੱਚ ਕੋਈ ਲਾਈਨ ਗਲਤ ਮਾਰ ਦੇਵਾਂ ਅਤੇ ਮੇਰੀ ਇੱਕ ਗੰਦੀ ਆਦਤ ਹੈ ਕਿ ਮੈਂ ਉਹਨੂੰ ਮਿਟਾ ਕੇ ਉਹਦੇ 'ਤੇ ਵਾਪਸ ਉਹੀ ਲਾਈਨ 'ਤੇ ਲਾਈਨ ਮਾਰ ਦਿੰਦਾ ਹਾਂ ਜੋ ਕਿ ਹੋਰ ਗਲਤ ਹੋ ਜਾਂਦਾ ਹੈ ਜੇ ਮੈਂ ਆਪਣੀ ਇੱਕ ਹੋਰ ਗੱਲ ਦੱਸਾਂ ਤਾਂ ਜਦ ਮੈਂ ਚਿੱਤਰਕਾਰੀ ਚਿੱਤਰ ਬਾਰੇ ਕੁਛ ਸੋਚ ਰਿਹਾ ਹੋਵਾਂ ਅਤੇ ਮੈਂ ਆਪਣੇ ਹੱਥ ਨਾਲ ਪੈਨਸਿਲ ਹਿਲਾਉਂਦਾ ਰਹਿੰਦਾ ਹਾਂ ਅਤੇ ਕਾਫ਼ੀ ਵਾਰੀ ਉਹ ਪੈਨਸਲ ਜ਼ਮੀਨ 'ਤੇ ਡਿੱਗ ਜਾਂਦੀ ਹੈ ਅਤੇ ਉਹ ਟੁੱਟ ਜਾਂਦੀ ਹੈ ਕਿਉਂਕਿ ਡਰਾਇੰਗ ਪੈਨਸਲਾਂ ਜਿਹੜੀਆਂ ਹੁੰਦੀਆਂ ਹਨ ਉਹਨਾਂ ਦਾ ਗਰੇਫਾਈਡ ਬਹੁਤ ਹੀ ਸੋਫਟ ਹੁੰਦਾ ਹੈ ਅਤੇ ਉਹ ਇੱਦਾਂ ਹੀ ਜ਼ਮੀਨ 'ਤੇ ਡਿੱਗ ਕੇ ਟੁੱਟ ਜਾਂਦੀ ਹੈ ਜੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਅਤੇ ਜਦੋਂ ਵੀ ਕੋਈ ਚਿੱਤਰ ਮੇਰੇ ਮਤਲਬ ਦਾ ਨਾ ਹੋਵੇ ਅਤੇ ਮੈਂ ਉਹਦੇ ਵਿੱਚ ਬਿਲਕੁੱਲ ਵੀ ਇੰਟਰਸਟ ਨਹੀਂ ਦਿਖਾਉਂਦਾ ਅਤੇ ਉਹਨੂੰ ਬਸ ਕਾਹਲੀ ਛੇਤੀ 'ਚ ਮਕਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਇੱਕ ਬਹੁਤ ਗੰਦੀ ਆਦਤ ਹੈ ਵੈਸੇ ਤਾਂ ਚਿੱਤਰਕਾਰੀ ਮੇਰੇ ਵਾਸਤੇ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਮੈਂ ਉਹਦੇ ਨਾਲ ਬਹੁਤ ਹੀ ਕੁਛ ਸਿੱਖਿਆ ਹੈ ਪਰ ਫਿਰ ਵੀ ਮੇਰੇ ਮੇਰੇ ਕੋਲ ਇਹ ਗੰਦੀਆਂ ਆਦਤਾਂ ਜ਼ਰੂਰ ਚਿੰਬੜੀਆਂ ਰਹਿਣਗੀਆਂ ਮੈ ਜੇ ਤੁਹਾਨੂੰ ਇੱਕ ਹੋਰ ਆਦਤ ਦੱਸਾਂ ਆਪਣੀ ਅਤੇ ਕਿ ਜਦੋਂ ਵੀ ਮੈਂ ਕੋਈ ਚਿੱਤਰ ਬਣਾਉਂਦਾ ਹਾਂ ਅਤੇ ਚਿੱਤਰ ਬਣਾਉਂਦੇ ਵੇਲੇ ਮੈਂ ਕਦੀ ਕਦੀ ਆਪਣਾ ਪੇਜ ਖਰਾਬ ਕਰ ਦਿੰਦਾ ਹਾਂ ਆਪਣੇ ਹੀ ਹੱਥ ਨਾਲ ਸਾਈਡ ਤੋਂ ਮੋੜ ਮੋੜ ਕੇ ਜੋ ਕਿ ਬਿਲਕੁੱਲ ਹੀ ਖਰਾਬ ਕਰ ਦਿੰਦਾ ਹੈ ਮੇਰੀ ਚਿੱਤਰਕਾਰੀ ਨੂੰ ਮੈਂ ਸਿਰਫ਼ ਇਹੀ ਕਹਿਣਾ ਚਾਹਾਂਗਾ ਇਹ ਗੱਲਾਂ ਦੇ ਉੱਪਰ ਕਿ ਇਨਸਾਨ ਇੱਕ ਗਲਤੀ ਦਾ ਮੂਰਖ ਹੈ ਅਤੇ ਇਨਸਾਨ ਨੂੰ ਆਪਣੀ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਮੈਂ ਵੀ ਆਪਣੀਆਂ ਗਲਤੀਆਂ ਤੋਂ ਜ਼ਰੂਰ ਸਿੱਖਾਂਗਾ ਅਤੇ ਤੁਸੀਂ ਵੀ ਆਪਣੀ ਗਲਤੀਆਂ ਤੋਂ ਜ਼ਰੂਰ ਸਿੱਖੋ ਸ਼ੁਕਰੀਆ